ਮੈਂ ਆਪਣੇ ਸਕੂਲ ਵਿੱਚ ਫੰਕਸ਼ਨ ਵਿੱਚ ਹਿੱਸਾ ਲਿਆ ਸੀ ਤੇ ਉਸ ਵਿੱਚ ਮੈਨੂੰ ਡਾਂਸ ਕੋਮਪੀਟੀਸ਼ਨ ਵਿਚ ਭਾਗ ਲਿਆ ਤੇ ਮੇਰਾ ਡਾਂਸ ਦੀ ਪਰਫਾਰਮੈਂਸ ਸਭ ਤੋਂ ਵਧੀਆ ਰਹੇ ਤੇ ਮੈਨੂੰ ਡਾਂਸ ਪ੍ਰਸੰਸਾ ਮੇਰੇ ਸਾਰੇ ਸਾਥੀਆਂ ਨੇ ਤੇ ਮੇਰੇ ਅਧਿਆਪਕ ਖਾਨੇ ਆ ਧਿਆਨ ਮੇਰੇ ਮਿੱਤਰਾਂ ਨੇ ਦੋਸਤਾਂ ਨੇ ਕੀਤੀ ਸੀ ਮੇਰੇ ਡਾਂਸ ਪ੍ਰਸੰਸਾ ਇਨੀ ਹੋਈ ਕਿ ਮੈਨੂੰ ਇਸ ਪ੍ਰਸੰਸਾ ਨੂੰ ਸੁਣ ਕੇ ਬਹੁਤ ਜਿਆਦਾ ਖੁਸ਼ੀ ਹੋਈ ਕਿ ਮੇਰਾ ਡਾਂਸ ਸਭ ਤੋਂ ਵਧੀਆ ਡਾਂਸ ਸੀ ਤੇ ਮੈਂ ਮੈਨੂੰ ਮੇਰੇ ਡਾਂਸ ਨਾਲ ਤਜਰਬਾ ਵੀ ਨਹੀਂ ਸੀਗਾ ਕਿ ਮੈਂ ਇਨਾ ਵਧੀਆ ਡਾਂਸ ਵਿੱਚ ਭਾਗ ਲਵਾਂਗੀ ਕਿ ਮੇਰਾ ਡਾਂਸ ਇੰਨਾ ਵਧੀਆ ਹੋਵੇਗਾ ਤੇ ਸਾਰੇ ਸਭ ਲੋਕ ਮੇਰੀ ਪ੍ਰਸੰਸਾ ਕਰਨਗੇ ਤੇ ਸਭ ਮੇਰੇ ਡਾਂਸ ਦੇ ਫੈਨ ਹੋ ਜਾਣਗੇ ਤੇ ਮੈਨੂੰ ਇਸ ਗੱਲਾਂ ਨੂੰ ਸੁਣ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਮੇਰੇ ਡਾਂਸ ਦੀ ਸਭ ਡਾਂਸ ਨਾਲੋਂ ਅਲੱਗ ਸੀ ਤੇ ਬਹੁਤ ਵਧੀਆ ਸੀ ਤੇ ਸਭ ਨੂੰ ਮੇਰਾ ਡਾਂਸ ਬਹੁਤ ਪਸੰਦ ਆਇਆ ਤੇ ਮੈ ਆਪਣੇ ਇਸ ਡਾਂਸ ਡਾਂਸ ਖੁਸ਼ੀ ਵਿੱਚ ਬਹੁਤ ਜਿਆਦਾ ਖੁਸ਼ ਹੋ ਕੇ ਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਅੱਗੇ ਵੀ ਆਪਣੀ ਡਾਂਸ ਤਾਂ ਕਰੀਅਰ ਵਧਾ ਸਕਦੇ ਹਾਂ ਤੇ ਅਨੇਕਾਂ ਪਾਰਟੀਸਪੀਟਾ ਵਿੱਚ ਆਪਣਾ ਡਾਂਸ ਦਾ ਕਰੀਅਰ ਸ਼ੁਰੂ ਕਰ ਸਕਦੀ ਆਂ ਮੈਨੇ ਕਾਫੀ ਫੰਕਸ਼ਨਾਂ ਤੇ ਹੀ ਅਨੇਕਾਂ ਤਿਉਹਾਰਾਂ ਦੀ ਡਾਂਸ ਵਿੱਚ ਪਾਰਟੀਸ੍ਪੇਟ ਕੀਤਾ ਤੇ ਮੇਰਾ ਡਾਂਸ ਦਾ ਤਜਰਬਾ ਬਹੁਤ ਹੀ ਜਿਆਦਾ ਵਧੀਆ ਰਵੇ ਤੇ ਬਹੁਤ ਵਧੀਆ ਪਸੰਦ ਹੋਵੇ ਸਭ ਨੂੰ ਮੇਰਾ ਡਾਂਸ ਮੈਂ ਡਾਂਸ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦੀ ਸੀ ਕਿ ਮੈਨੂੰ ਡਾਂਸ ਕਰਨ ਵਿੱਚ ਬਹੁਤ ਜਿਆਦਾ ਖੁਸ਼ ਹੁੰਦੀ ਸੀ ਕਿ ਲੋਕਾਂ ਮੈਨੂੰ ਜੋ ਗੱਲਾਂ ਮੈਨੂੰ ਬਸ ਸਾਨੂੰ ਜਿਸ ਜੋ ਗੱਲਾਂ ਕਹਿੰਦੀ ਸੀ ਵੀ ਨਾ ਸਮਾਰੇ ਤਾਂ ਮੈਨੂੰ ਬਹੁਤ ਪਸੰਦ ਆਈਆਂ ਤੇ ਮੇਰਾ ਡਾਂਸ ਆ ਵਿਚ ਵਿਸ਼ਵਾਸ ਹੋਰ ਵਧ ਗਿਆ ਕਿ ਜੋ ਮੇਰਾ ਡਾਂਸ ਹੈ ਤੇ ਸਭ ਤੋਂ ਵਧੀਆ ਡਾਂਸ ਹੁੰਦਾ ਹੈ ਤੇ ਮੈਨੂੰ ਡਾਂਸ ਕਰਨ ਵਿੱਚ ਬਹੁਤ ਦਿਲਚਸਪੀ ਵਧ ਗਈ ਤੇ ਮੇਰੇ ਨਾਲ ਸਭ ਤੋਂ ਵਧੀਆ ਡਾਂਸ ਸੀ ਤੇ ਪਸੰਦੀਦਾ ਮੇਰਾ ਡਾਂਸ ਬਣ ਗਿਆ ਤੇ ਮੈਨੂੰ ਕਦੇ ਮਹਿਸੂਸ ਵੀ ਨਹੀਂ ਦਿੱਤਾ ਸੀ ਕਿ ਮੇਰਾ ਡਾਂਸ ਇਨਾ ਵਧੀਆ ਬਣ ਜਾਊਗਾ ਕਿ ਸਾਰੇ ਇਸ ਡਾਂਸ ਦੇ ਫੈਨ ਹੋ ਜਾਣਗੇ